ਮੇਰਾ ਨਾਮ ਭਾਰਤ ਭੂਸ਼ਣ ਮੈਂ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਅਤੇ ਪਠਾਨਕੋਟ ਜਿਲ੍ਹਾ ਮੇਰਾ ਅਤੇ ਜੇ ਗੱਲ ਕਰੀਏ ਬੀਚ ਦੀ ਬੀਚ ਸਾਨੂੰ ਜੁਗਿਆਲ ਦੇ ਲਾਗੇ ਥੋੜ੍ਹੀ ਜਿਹੀ ਅੱਗੇ ਜਾ ਕੇ ਬਸੋਲੀ ਦੀ ਸਾਈਡ 'ਤੇ ਜਾ ਕੇ ਨਾ ਇੱਕ ਪਿੰਡ ਪੈਂਦਾ

ਮਿੰਨੀ ਗੋਆ ਦੇ ਨਾਂ ਨਾਲ ਜਾਣਿਆ ਜਾਂਦਾ ਉੱਥੇ ਬੀਚ ਹੈ ਬੀਚ ਬਹੁਤ ਵਧੀਆ ਉੱਥੇ ਤੈਰਾਕੀ ਕਰਨ ਵਾਸਤੇ ਬਹੁਤ ਵਧੀਆ ਜਗ੍ਹਾ ਆ ਅਤੇ ਨਾਲ ਦੀ ਨਾਲ ਉੱਥੇ ਫੋਰ ਵਾਈ ਫੋਰ ਗੱਡੀਆਂ ਜਿੰਨੀ ਟੂ ਸੀਟਰ ਗੱਡੀਆਂ ਦੀ ਰਾਈਡਿੰਗ ਵੀ ਕੀਤੀ ਜਾਂਦੀ ਆ ਅਤੇ ਨਾਲ ਕਾਫ਼ੀ ਜ਼ਿਆਦਾ ਖੇ ਦੇਖਣ ਦੀ ਜਗ੍ਹਾ ਆ ਅਤੇ ਸਾਡੇ ਲਾਗੇ ਬਸੋਲੀ ਪੁੱਲ ਵੀ ਪੈਂਦਾ ਅਤੇ ਝੀਲ ਦੀ ਗੱਲ ਕੀਤੀ ਜਾਵੇ ਤਾਂ ਝੀਲ ਸਾਡੇ ਲਾਗੇ ਰਾਵੀ ਰਿਵਰ ਵਗਦਾ ਆ ਅਤੇ ਉੱਥੇ ਵੀ ਕਾਫ਼ੀ ਲੋਕ ਇੰਜੋਏ ਕਰਨ ਆਉਂਦੇ ਆ ਵਿਸਾਖੀ ਦਾ ਮੇਲਾ ਤਾਂ ਸਾਡੇ ਇੱਧਰ ਬਹੁਤ ਵਧੀਆ ਲੱਗਦਾ ਜਿੱਥੇ ਲੋਕ ਵਿਸਾਖੀ ਨਹਾਉਣ ਵਾਸਤੇ ਆਉਂਦੇ ਆ ਅਤੇ ਗੱਲ ਇੱਦਾਂ ਹੋਈ ਕਿ ਜਿਹੜਾ ਝੀਲ ਦੀ ਗੱਲ ਆ ਅਤੇ ਝੀਲ ਸਾਡੇ ਲਾਗੇ ਰਾਵੀ ਰਿਵਰ ਵਗਦਾ ਅਤੇ ਰਾਵੀ ਰਿਵਰ ਦਾ ਪਾਣੀ ਆਪ ਜੀ ਨੂੰ ਪਤਾ ਹੀ ਆ ਬਹੁਤ ਮਿੱਠਾ ਆ ਅਤੇ ਬਹੁਤ ਵਧੀਆ ਅਤੇ ਨਾਲ ਦੀ ਨਾਲ ਅਸੀਂ ਬਚਪਨ ਤੋਂ ਹੀ ਸਵਿਮਿੰਗ ਦਾ ਸ਼ੌਂਕ ਰੱਖਦੇ ਸੀ ਪਹਿਲਾਂ ਪਹਿਲਾਂ ਤਾਂ ਸਾਨੂੰ ਡਰ ਲੱਗਦਾ ਸੀ ਫਿਰ ਅਸੀਂ ਇੱਥੇ ਨ ਨਹਾਉਣਾ ਸ਼ੁਰੂ ਕਰਤਾ ਅਤੇ ਪਹਿਲਾਂ ਤਾਂ ਛੋਟੇ ਛੋਟੇ ਪਾਣੀ 'ਚ ਨਹਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਅਸੀਂ ਵਗਦੇ ਪਾਣੀ ਨੂੰ ਪਾਰ ਆਰ ਕਰਨਾ ਸ਼ੁਰੂ ਕਰਤਾ ਉਸ ਤੋਂ ਬਸ ਸਵੀਮਿੰਗ ਦਾ ਸ਼ੌਂਕ ਪੈ ਗਿਆ ਸ਼ੌਂਕ ਪੈਣ ਤੋਂ ਬਾਅਦ ਫਿਰ ਅਸੀਂ ਸਕੂਲ ਟਾਈਮ ਦੇ ਵਿੱਚ ਸਪੋਰਟਸ ਦੇ ਵਿੱਚ ਸਵੀਮਿੰਗ ਰਖਵਾ ਲਈ ਸਵੀਮਿੰਗ ਰਖਵਾ ਲਈ ਤੇ ਉਸਦੀ ਟ੍ਰੇਨਿੰਗ ਸਾਡੀ ਐਸ ਡੀ ਗਰਾਊਂਡ ਅਤੇ ਨਾਲ ਲੱਗਦਾ ਸਵੀਮਿੰਗ ਪੂਲ ਹੈ ਸਰਕਾਰੀ ਉੱਥੇ ਸਾਡੀ ਟ੍ਰੇਨਿੰਗ ਲੱਗ ਗਈ ਉੱਥੇ ਸਾਨੂੰ ਮੈਡਮ ਬਨੀ ਬੰਦਨਾ ਜੀ ਨੇ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਦੇ ਵਿੱਚ ਸਾਨੂੰ ਬੈਕਸਟਰੋਕ ਬਟਰਫਲਾਈ ਅਤੇ ਸੌ ਮੀਟਰ ਰੇਲੇ ਪੰਜ ਸੌ ਮੀਟਰ ਰੇਲੇ ਦੀ ਟ੍ਰੇਨਿੰਗ ਕਰਵਾਈ ਗਈ ਜਿਸ ਦਾ ਫਿਰ ਸਾਨੂੰ ਜਿਲ੍ਹਾ ਲੈਵਲ 'ਤੇ ਕੰਪੀਟੀਸ਼ਨ ਵਾਸਤੇ ਜਲੰਧਰ ਭੇਜਿਆ ਗਿਆ ਜਲੰਧਰ ਕੰਪਟੀਸ਼ਨ ਦੇ ਵਿੱਚ ਸਾਡੀ ਟੀਮ ਨੇ ਸੌ ਮੀਟਰ ਰੇਲੇ ਦੇ ਵਿੱਚ ਵੀ ਭਾਗ ਲਿਆ ਚਾਰ ਸੌ ਮੀਟਰ ਰੇਲੇ ਵਿੱਚ ਵੀ ਭਾਗ ਲਿਆ ਬਟਰਫਲਾਈ ਦੇ ਵਿੱਚ ਵੀ ਭਾਗ ਲਿਆ ਸਾਰਿਆਂ ਦੇ ਵਿੱਚ ਉਹਨਾਂ ਨੇ ਸੈਕਿੰਡ ਸਥਾਨ ਪ੍ਰਾਪਤ ਕੀਤਾ ਬਹੁਤ ਵਧੀਆ ਲੱਗਿਆ ਸਾਨੂੰ ਸਨਮਾਨਿਤ ਵੀ ਕੀਤਾ ਗਿਆ ਸਨਮਾਨਿਤ ਕਰਕੇ ਸਾਨੂੰ ਵਾਪਿਸ ਪਿੰਡ ਸਕੂਲ ਦੇ ਵਿੱਚ ਲਿਆਂਦਾ ਗਿਆ ਸਕੂਲ ਵਾਲਿਆਂ ਨੇ ਵੀ ਸਨਮਾਨਿਤ ਕੀਤਾ ਸਰਟੀਫਿਕੇਟ ਮਿਲੇ ਟਰੋਫੀਜ ਮਿਲੀ ਬਹੁਤ ਵਧੀਆ ਲੱਗਿਆ ਜੀ ਮੈਂ ਵੀ ਕਹਿੰਦਾ ਕਿ ਹਰ ਕੋਈ ਸਵਿਮਿੰਗ ਸਿੱਖੇ ਬਚਪਨ ਦਾ ਸ਼ੌਂਕ ਪੂਰਾ ਕਰੇ ਧੰਨਵਾਦ ਜੀ